ਹੁਣ ਤਾਂ ਜਿਹੜੀ ਆਪਾਂ ਫਿਲਮ ਵੇਖਣ ਦੀ ਗੱਲ ਕਰਦੇ ਪਏ ਸੀ ਉਸ ਦਾ ਸਮਾਂ ਅਤੇ ਸਕਰੀਨਿੰਗ ਦਾ ਸਮਾਂ ਵੀ ਆ ਚੁੱਕਿਆ ਹੈ ਮੈਂ ਬਹੁਤ ਜ਼ਿਆਦਾ ਉਤਸੁਕ ਹਾਂ ਮੈਂ ਬਹੁਤ ਟਾਈਮ ਦੀ ਉਸਦੀ ਵੇਟ ਕਰ ਰਹੀ ਸੀ ਹੁਣ ਮੈਨੂੰ ਲੱਗਦਾ ਨਾਲ ਆਪਾਂ ਨੂੰ ਉਹ ਫਿਲਮ ਵੇਖਣ ਜਾਣੀ ਚਾਹੀਦੀ ਹੈ ਮੈਂ ਅਗਲੇ ਸ਼ੁੱਕਰਵਾਰ ਵਿਹਲੀ ਹਾਂ ਨਾਲ ਸ਼ਾਮ ਦੇ ਵੇਲੇ ਫਿਲਮ ਵੇਖ ਕੇ ਆਪਾਂ ਉਸ ਤੋਂ ਬਾਅਦ ਖਾਣਾ ਵੀ ਖਾ ਸਕਦੇ ਹਾਂ ਮੈਨੂੰ ਤਾਂ ਲੱਗਦਾ ਆਪਾਂ ਨੂੰ ਅਗਲੇ ਸ਼ੁੱਕਰਵਾਰ ਫਿਲਮ ਵੇਖਣ ਚਲੇ ਜਾਣਾ ਚਾਹੀਦਾ ਹੈ